ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਜਸਪ੍ਰੀਤ ਸਿੰਘ ਦਾ ਡੈਡੀ ਬੋਲਦਾਂ ਜੀ ਅਤੇ ਉਹ ਮ ਮੇਰੇ ਬੱਚੇ ਦਾ ਜੀ ਐੱਮ ਐੱਸ ਟੀ ਹੋਏ ਜੀ ਫਸਟ ਜੀ ਮੈਂ ਤੁਹਾਡੀ ਪੇਰੈਂਟਸ ਮੀਟਿੰਗ ਅਟੈਂਡ ਨਹੀਂ ਕਰ ਸਕਿਆ ਜੀ ਅਤੇ ਉਹਦੇ ਐੱਸ ਟੀ ਫਸਟ ਐੱਸ ਟੀ ਬਾਰੇ ਜਾਣਨਾ ਚਾਹੁੰਦਾ ਜੀ ਕਿਵੇਂ ਕਿ ਕਿਵੇਂ ਫੋਰਮਿਸ ਬੱਚੇ ਦੀ ਜੀ ਹਾਂਜੀ ਉਹ ਨਹੀਂ ਕੋਈ ਗੱਲ ਨਹੀਂ ਉਹਦਾ ਤਾਂ ਆਪਾਂ ਧਿਆਨ ਦੇਵਾਂਗੇ ਅਤੇ ਉਹਦਾ ਟਿਊਸ਼ਨ ਵੀ ਰਖਾ ਦਿੰਦੇ ਆ ਜੀ ਉਹਨੇ ਕੋਈ ਗੱਲ ਨਹੀਂ ਬੱਚਿਆਂ ਦਾ ਅਤੇ ਬਾਕੀ ਸਬਜੈਕਟ 'ਚੋਂ ਕਿਵੇਂ ਆ ਜੀ ਹਾਂਜੀ ਅੱਛਾ ਜੀ ਅਤੇ ਹੋਰ ਅਟੈਂਡਸ ਕਿਵੇਂ ਬੱਚੇ ਦੀ ਹਾਂਜੀ ਚਲੋ ਅਸੀਂ ਵੀ ਧਿਆਨ ਦੇਵਾਂਗੇ ਤੁਸੀਂ ਵੀ ਧਿਆਨ ਦਿਉ ਜੀ ਬੱਚੇ ਵੱਲ ਥੋੜ੍ਹਾ ਜਿਹਾ ਜੀ ਅੱਛਾ ਜੀ ਚਲੋ ਮੈਂ ਕਰਦਾ ਜੋਬ ਜੀ ਅਤੇ ਮੇਰਾ ਥੋੜ੍ਹਾ ਜਿਹਾ ਹਫਤੇ ਬਾਅਦ ਮੈਂ ਆਉਂਦਾ ਜੀ ਪਿੰਡ ਦੂਰ ਆ ਜੋਬ ਮੇਰੀ ਅਤੇ ਕੋਈ ਗੱਲ ਨਹੀਂ ਮੈਂ ਵੀ ਗੇੜਾ ਰੱਖੂ ਮੈਂ ਹੋਰ ਡਿਊਟੀ ਲਾਉਣਾ ਆਪਣੇ ਨਾਲ ਦੇ ਦੀ ਕਿਸੇ ਨੂੰ ਕਹਿੰਦਾ ਜੀ ਹਾਂ ਅੱਛਾ ਸਰ

ਠੀਕ ਹੈ ਸਰ ਜੀ